ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂ ਵੀਰ ਜੀ ਠੀਕ ਠਾਕ ਦੱਸੋ ਤੁਸੀਂ ਆਪਣੀ ਸੁਣਾਓ ਹਾਂਜੀ ਹਾਂ ਦੱਸੋ ਹਾਂਜੀ ਕੋਈ ਗੱਲ ਮੈਂ ਤੇ ਤਾਂ ਕਰਦੀ ਹਾਂ ਕਿ ਦੇਖੋ ਜੀ ਬੂਹੇ ਦਰਵਾਜ਼ੇ ਅੱਗੇ ਸਾਰੀ ਸਾਫ ਸਫਾਈ ਰਹਿੰਦੀ ਹੈ ਇਸ ਵਾਸਤੇ ਕਿਉਂਕਿ ਕੂੜੇ ਵਾਲਾ ਆਉਂਦਾ ਨਹੀਂ ਪਿਆ ਅਤੇ ਜੇਕਰ ਕੂੜੇ ਵਾਲੇ ਆ ਜਾਣਗੇ ਤਾਂ ਕੂੜੇ ਵਾਲੇ ਚੁੱਕ ਕੇ ਲੈ ਜਾਣਗੇ ਫਿਰ ਇਹ ਤਾਂ ਚਾਹੀਦਾ ਨਾ ਮਤਲਬ ਕਿ ਬੂਹੇ ਅੱਗੇ ਝਾੜੂ ਲਗਾਉਣਾ ਜੇਕਰ ਤੁਸੀਂ ਅੱਗੇ ਚਾਹੁੰਦੇ ਹੋ ਤਾਂ ਅੱਗੇ ਤੋਂ ਅਸੀਂ ਨਹੀਂ ਝਾੜੂ ਲਗਾਵਾਂਗੇ ਕੋਈ ਗੱਲ ਨਹੀਂ ਸੋਰੀ ਭਾਅ ਜੀ ਕੋਈ ਗੱਲ ਨਹੀਂ ਕਿਉਂਕਿ ਸਾਰੇ ਹੁਣ ਸਾ ਸਾਰੇ ਹੁਣ ਗੰਦ ਪਿਆ ਹੋਇਆ ਅਸੀਂ ਸਫਾਈ ਕਰਾਂਗੇ ਤਾਂ ਅਸੀਂ ਆਪ ਵੀ ਸਹੀ ਰਵਾਂਗੇ ਗੰਦ ਪਾ ਕੇ ਬੰਦਾ ਚੰਗਾ ਨਹੀਂ ਲੱਗਦਾ ਜੇਕਰ ਤੁਸੀਂ ਕਹੋਗੇ ਤਾਂ ਅਸੀਂ ਅੱਗੇ ਤੋਂ ਬਿਲਕੁਲ ਨਹੀਂ ਤੁਹਾਡੇ ਬੂਹੇ ਅੱਗੇ ਝਾੜੂ ਲਗਾਵਾਂਗੇ ਕੋਈ ਨਹੀਂ ਮੈਂ ਇਕੱਠਾ ਕਰਕੇ ਡਸਟਬੀਨ 'ਚ ਪਾ ਦਾਂਗੀ ਜੇਕਰ ਕੂੜੇ ਵਾਲੇ ਆਉਣਗੇ ਤਾਂ ਕੂੜੇ ਵਾਲੇ ਚੁੱਕ ਕੇ ਲੈ ਜਾਣਗੇ ਕੋਈ ਨਹੀਂ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਹੀਂ ਕੋਈ ਨਹੀਂ ਝਾੜੂ ਜੇ ਲਗਾਉਣਾ ਜ਼ਰੂਰੀ ਹੁੰਦਾ ਨਾ ਇਸ ਵਾਸਤੇ ਕਿ ਮੈਂ ਤਾਂ ਝਾੜੂ ਲਗਾਨੀ ਹਾਂ ਕਿ ਸਾਰੀ ਗੰਦ ਨਹੀਂ ਲੱਗਦਾ ਬੂਹੇ ਅੱਗੇ ਸਫਾਈ ਰਹਿੰਦੀ ਹੈ ਆਪ ਵੀ ਅਸੀਂ ਸਾਫ ਸੁਥਰੇ ਰਵਾਂਗੇ ਜੇਕਰ ਸਾਫ ਸੁਥਰੇ ਰਵਾਂਗੇ ਤਾਂ ਚੰਗਾ ਲੱਗੇਗਾ ਕੋਈ ਨਹੀਂ ਤੁਸੀਂ ਗੁੱਸਾ ਕਰ ਗਏ ਹੋ ਕੋਈ ਨਹੀਂ ਅਸੀਂ ਅੱਗੋਂ ਤੋਂ ਬਿਲਕੁਲ ਕੋਈ ਨਹੀਂ ਮਿਹਰਬਾਨੀ ਠੀਕ ਆ ਜੀ ਠੀਕ ਆ ਓਕੇ